ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ

ਸਰ ਮੇਰੇ ਕੋਲ ਬਹੁਤ ਤਰ੍ਹਾਂ ਦੀਆਂ ਪੋਲਿਸੀਜ਼ ਨੇ ਤੁਸੀਂ ਕਿਹੜੇ ਤਰ੍ਹਾਂ ਦੀ ਪੋਲਿਸੀਜ਼ ਤੁਹਾਡੀ ਹੈਲਪ ਹੋ ਸਕਦੀ ਹੈ ਲੈਟ ਮੀ ਐਕਸਪਲੇਨ ਲੈਟ ਮੀ ਐਕਸਪਲੇਨ ਮੈਂ ਤੁਹਾਨੂੰ ਸਮਝਾਉਂਦੀ ਹਾਂ ਇਹ ਇਹ ਅਪ ਜਿਹੜੇ ਆਪਣੇ ਸੋਰਸਿਜ ਨੇ ਆਪਣੇ ਇਨਵਾਇਰਮੈਂਟ 'ਚ ਉਹ ਬਹੁਤ ਘੱਟ ਨੇ ਅਤੇ ਜਿਹੜੀਆਂ ਆਪਣੀਆਂ ਡਿਮਾਂਡਸ ਨੇ ਉਹ ਬਹੁਤ ਜ਼ਿਆਦਾ ਨੇ ਅਤੇ ਜਿਹੜਾ ਮਾਰਕੀਟ ਹੈ ਉਹ 'ਚ ਬਹੁਤ ਜ਼ਿਆਦਾ ਆਪਣਾ ਉਹ ਹੈ ਕੋਂਪੀਟੀਸ਼ਨ ਜ਼ਿਆਦਾ ਆ ਅਤੇ ਇਸ ਲਈ ਇਸ ਲਈ ਜਿਹੜੇ ਆਪਣੇ ਬਿਜਨਸ ਨੂੰ ਆਪਾਂ ਨੂੰ ਪਲਾਨ ਕਰਕੇ ਚੱਲਣਾ ਪੈਣਾ ਹਾਂਜੀ ਇਸ ਕਰਕੇ ਆਪਾਂ ਨੂੰ ਪਹਿਲਾਂ ਤਾਂ ਚੈੱਕ ਕਰਨਾ ਚਾਹੀਦਾ ਕਿ ਆਪਣਾ ਜਿਹੜਾ ਬਿਜ਼ਨਸ ਆ ਉਹ ਉਹਦਾ ਜਿਹੜਾ ਆਪਾਂ ਬਣਾਇਆ ਹੋਇਆ ਸੀਗਾ ਪਲੈਨ ਉਹ ਸਹੀ ਸਹੀ ਚੱਲ ਰਿਹਾ ਜਿਹੜਾ ਪਲੈਨ ਬਣਾਇਆ ਸੀ ਉਵੇਂ ਹੀ ਚੱਲ ਰਿਹਾ ਸਾਰਾ ਕੁਛ ਹਾਂਜੀ ਅਤੇ ਫਿਰ ਜੇ ਜਿਹੜੇ ਤੁਹਾਡੇ ਬਿਜ਼ਨਸ 'ਚ ਵਰਕਰਸ ਹੋਣਗੇ ਤਾਂ ਉਹਨਾਂ ਨੂੰ ਵੀ ਵੇਖਣਾ ਵੀ ਸਹੀ ਤਰ੍ਹਾਂ ਕੰਮ ਕਰ ਰਿਹਾ ਕਿ ਉਹ ਨਹੀਂ ਕਰ ਰਹੇ ਜੇ ਉਹ ਸਹੀ ਤਰ੍ਹਾਂ ਨਹੀਂ ਕੰਮ ਕਰ ਰਹੇ ਫਿਰ ਆਪਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਮੋਟੀਵੇਸ਼ਨ ਆ ਉਹ ਬਹੁਤ ਹੈਲਪ ਕਰਦਾ ਆਪਣੇ ਬਿਜਨਸ ਨੂੰ ਐਕਸਪੈਂਡ ਕਰਨ ਵਿੱਚ ਕੰਮ ਨਹੀਂ ਕਰ ਰਹੀ ਚਲੋ ਫਿਰ ਮੈਂ ਤੁਹਾਨੂੰ ਕੁਛ ਪ੍ਰਿੰਸੀਪਲਸ ਨੂੰ ਸਮਝਾਉਂਦੀ ਹਾਂ ਜਿਹਦੇ ਨਾਲ ਆਪਾਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਪਹਿਲਾਂ ਤਾਂ ਡਿਵਿਜ਼ਨ ਆਫ ਵਰਕ ਇਹਦੇ ਇਹਦੇ ਵਿੱਚ ਨਾ ਆਪਾਂ ਕੀ ਕਰਦੇ ਹਾਂ ਕਿ ਜਿਹੜੇ ਵਰਕਰ ਨੇ ਉਹ ਜੇ ਜਿਵੇਂ ਦੋ ਕੰਮ ਨੇ ਆਪਾਂ ਉਸ ਦੋ ਕੰਮ ਨੂੰ ਜ ਪਹਿਲਾਂ ਤਾਂ ਇੱਕ ਹੀ ਵਰਕਰ ਕੰਮ ਕਰ ਰਿਹਾ ਜੇ ਆਪਾਂ ਉਹਨਾਂ ਦੋ ਕੰਮਾਂ ਨੂੰ ਦੋ ਵਰਕਰ ਹੀ ਲਾਈਏ ਤਾਂ ਇੱਕ ਕੰਮ ਨੂੰ ਇੱਕ ਵਰਕਰ ਲਾਈਏ ਤਾਂ ਆਪਣਾ ਜਿਹੜਾ ਵਰਕਰਜ਼ ਨੇ ਉਹ ਵੀ ਸਪੈਸ਼ਲ ਲਾਈਜ਼ ਹੋ ਜਾਣਗੇ ਮਤਲਬ ਉਹ ਆਪਣੇ ਕੰਮ 'ਚ ਐਕਸਪਰਟ ਹੋ ਜਾਣਗੇ ਇਸ ਨਾਲ ਜਿਹੜਾ ਆਪਣਾ ਉਹ ਵੀ ਬਿਜ਼ਨਸ ਵੀ ਆਪਣਾ ਐਕਸਪੈਂਡ ਕਰੂਗਾ ਇਸ ਨਾਲ ਆਪਾਂ ਨੂੰ ਪ੍ਰੋਫਿਟ ਵੀ ਹੋਵੇਗਾ ਆਪਾਂ ਕੰ ਮਾਰਕੀਟ 'ਚ ਸਰਵਾਈਵ ਵੀ ਕਰ ਸਕਦੇ ਹਾਂ ਅਤੇ ਆਪਣਾ ਜਿਹੜਾ ਪ੍ਰੋਫਿਟ ਵੀ ਬਹੁਤ ਜ਼ਿਆਦਾ ਹੋਏ ਕਦੇ ਗਰੋਥ ਵੀ ਬਹੁਤ ਜ਼ਿਆਦਾ ਹੋਏਗੀ ਅਤੇ ਇਸ ਨਾਲ ਆਪਾਂ ਬਹੁਤ ਲੰਬੇ ਟਾਈਮ 'ਚ ਮਾਰਕਿਟ 'ਚ ਸਰਵਾਈਵ ਕਰ ਸਕਦੇ ਹਾਂ ਅਤੇ ਦੂਜਾ ਪ੍ਰਿੰਸੀਪਲ ਹੈਗਾ ਸਬੋਡੀਨੇਸ਼ਨ ਆਫ ਇੰਡੀਵਿਜਅਲ ਇੰਟਰਸਟ ਟੂ ਜਨਰਲ ਇੰਟਰਸਟ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਿਹੜੇ ਆਪਣਾ ਵਰਕਰਸ ਦਾ ਆਪਣਾ ਇੰਟਰਸਟ ਆ ਉਹਨੂੰ ਛੱਡ ਦਿੰਦੇ ਹਾਂ ਜਿਹੜੇ ਵਰਕਰਸ ਨੇ ਉਹਨਾਂ ਨੂੰ ਛੱਡਣਾ ਚਾਹੀਦਾ ਜਿਹੜਾ ਉਹਨਾਂ ਉਹਨਾਂ ਦਾ ਆਪਣਾ ਇੰਟਰਸਟ ਹੈ ਅਤੇ ਜਿਹੜਾ ਔਰਗਨਾਈਜੇਸ਼ਨ ਦਾ ਗੋਲ ਆ ਜਿਹੜਾ ਆਰਗਨਾਈਜੇਸ਼ਨ ਦਾ ਓਬਜੈਕਟਿਵ ਆ ਆਪਾਂ ਨੂੰ ਉਹਨਾਂ ਉਹਨੂੰ ਵੀ ਲੈਣਾ ਚਾਹੀਦਾ ਉਹਨੂੰ ਵੀ ਸਭ ਤੋਂ ਅੱਗੇ ਰੱਖਣਾ ਚਾਹੀਦਾ ਠੀਕ ਹੈ ਇਸ ਨਾਲ ਜਿਹੜਾ ਆਪਣਾ ਬਿਜਨਸ ਆ ਉਹ ਵੀ ਐਕਸਪੈਂਡ ਕਰ ਗਿਆ ਅਤੇ ਜਿਹੜੇ ਵਰਕਰਜ਼ ਆ ਉਹ ਵੀ ਮੋਟੀਵੇਟ ਰਹਿਣਗੇ ਕਿਉਂਕਿ ਆਪ ਆਪਾਂ ਨੂੰ ਉਹਨਾਂ ਨੂੰ ਰੀਮਨੇਸ਼ਨ ਵੀ ਦੇਣੀ ਪਏਗੀ ਮਤਲਬ ਆਪਾਂ ਨੂੰ ਉਹਨਾਂ ਨੂੰ ਸੈਲਰੀ ਵੀ ਸਹੀ ਦੇਣੀ ਪਏਗੀ ਮਤਲਬ ਜੇ ਕੋਈ ਵਰਕਰ ਫਾਈਵ ਹਾਰ ਪੰਜ ਘੰਟਿਆਂ ਲਈ ਕੰਮ ਕਰ ਰਿਹਾ ਤਾਂ ਆਪਾਂ ਨੂੰ ਉਹਨਾਂ ਨੂੰ ਓਨੀ ਅ ਸੈਲਰੀ ਦੇਣੀ ਚਾਹੀਦੀ ਆ ਓਨੀ ਤਨਖ਼ਾਹ ਦੇਣੀ ਚਾਹੀਦੀ ਆ ਅਤੇ ਜੇ ਕੋਈ ਦਸ ਘੰਟਿਆਂ ਲਈ ਕਰ ਰਿਹਾ ਤਾਂ ਆਪਾਂ ਨੂੰ ਉਹ ਵਧਾ ਕੇ ਤਨਖ਼ਾਹ ਦੇਣੀ ਚਾਹੀਦੀ ਹੈ ਜਿਹਦੇ ਨਾਲ ਜਿਹੜੇ ਵਰਕਰਸ ਨੇ ਉਹਨਾਂ ਦਾ ਵੀ ਐਂ ਹੋਏਗਾ ਕਿ ਸਾਨੂੰ ਆ ਸਾਨੂੰ ਵੀ ਪੈਸੇ ਮਿਲ ਗਿਆ ਸਾਡੇ ਕੰਮ ਬਦਲੇ ਅਸੀਂ ਫਰੀ 'ਚ ਆਪਣਾ ਕੰਮ ਨਹੀਂ ਦੇ ਰਿਹਾ ਅਸੀਂ ਆਪਣਾ ਅ ਅਸੀਂ ਆਪਣਾ ਪ੍ਰੋਫਿਟ ਵੀ ਕਰ ਅ ਮਿਨੀਮਾਈਜ਼ ਕਰ ਰਹੇ ਹਾਂ ਮੈਕਸੀਮਾਈਜ ਕਰ ਰਹੇ ਹਾਂ ਹੈਲੋ ਹਾਂਜੀ ਤੇ ਤੀਜਾ ਹੈਗਾ ਏ ਐਸਟਰਿਕ ਦੁਕਾਬ ਉਸ ਦੇ ਵਿੱਚ ਕੀ ਹੁੰਦਾ ਜਿਹੜੇ ਵਰਕਰਸ ਨੇ ਉਹ ਇਕੱਲੇ ਇਕੱਲੇ ਕੰਮ ਨਹੀਂ ਕਰਦੇ ਉਹਨਾਂ ਦੀ ਆਪਾਂ ਇੱਕ ਟੀਮ ਬਣਾ ਦਿੰਦੇ ਹਾਂ ਜਿਸ ਨਾਲ ਜੇ ਇੱਕ ਵਰਕਰ ਛੁੱਟੀ 'ਤੇ ਆ ਜਾਂ ਉਹ ਬਿਮਾਰ ਹੋ ਗਿਆ ਵਾ ਤਾਂ ਉਹਦੇ ਵੰਡੇ ਦਾ ਕੰਮ ਜਿਹੜੇ ਉਹਨਾਂ ਦੀ ਟੀਮ 'ਚ ਉਹ ਹੋਣਗੇ ਬੰਦੇ ਉਹ ਹੀ ਕਰ ਦੇਣਗੇ ਅਤੇ ਜਿਹੜਾ ਆਪਣਾ ਆਪਣਾ ਗ ਫਰਮ ਦਾ ਗੋਲ ਹੋਏਗਾ ਉਹ ਵੀ ਅਚੀਵ ਹੋ ਜੇਗਾ ਉਹ ਵੀ ਪੂਰਾ ਹੋ ਜੇਗਾ ਕੀ ਕੀ ਇਹ ਵਾਲੇ ਪ੍ਰਿੰਸੀਪਲ ਤੁਹਾਡੇ ਬਿਜ਼ਨਸ ਵਿੱਚ ਹੈਲਪ ਕਰ ਸਕਦੇ ਆ ਖੁੱਲ੍ਹ ਕੇ ਦੱਸੋ ਮੈਨੂੰ ਕਿ ਕੀ ਇਹ ਬਿਜ਼ਨਸ ਇਹ ਵਾਲੀ ਪ੍ਰਿੰਸੀਪਲਸ ਨੂੰ ਲਗਾ ਕੇ ਹਾਂਜੀ ਪਰ ਉਹ ਬ ਫਰਮ ਟੂ ਫਰਮ ਮੈਟਰ ਕਰਦਾ ਨਾ ਕਿ ਤੁਹਾਡਾ ਬਿਜ਼ਨਸ ਕਿਹੋ ਜਿਹਾ ਹੈ ਬਿਜਨਸ ਵੀ ਅਲੱਗ ਅਲੱਗ ਪ੍ਰਕਾਰ ਦੇ ਹੁੰਦੇ ਆ ਨਾ ਬਸ ਠੀਕ ਆ ਜੇ ਤੁਹਾਨੂੰ ਲੱਗਦਾ ਕਿ ਹੋ ਜਾਏਗਾ ਫਿਰ ਤੁਹਾਨੂੰ ਇਹਨੂੰ ਅਪਲਾਈ ਕਰ ਦੇਣਾ ਚਾਹੀਦਾ ਤੁਹਾਨੂੰ ਦੇਖਣਾ ਚਾਹੀਦਾ ਕਿ ਇਹ ਜੇ ਤਾਂ ਇਹ ਕਰ ਰਿਹਾ ਕੰਮ ਫਿਰ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਹੋਰ ਕੋਈ ਪ੍ਰਿੰਸੀਪਲ ਵੀ ਲਗਾ ਸਕਦੇ ਹਾਂ ਆਪਾਂ ਹੋਰ ਕੋਈ ਪੋਲਿਸੀ ਵੀ ਲਗਾ ਸਕਦੇ ਹਾਂ ਤੁਹਾਡੇ ਬਿਜ਼ਨਸ ਦੇ ਵਿੱਚ ਓਕੇ ਠੀਕ ਹੈ ਜੀ ਧੰਨਵਾਦ ਓਕੇ ਓਕੇ